ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਬਹੁਤ ਹੀ ਜ਼ਿਆਦਾ ਕਾਰਨ ਹਨ ਜਿਨ੍ਹਾਂ ਵਿੱਚੋਂ ਕੁਝ ਮੁੱਖ ਕਾਰਨ ਜੋ ਆਪ ਜੀ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ੍ਹ ਇਹ ਜੋ ਖੁਦਕੁਸ਼ੀਆਂ ਹਨ ਬਹੁਤ ਹੀ ਜ਼ਿਆਦਾ ਵੱਧ ਰਹੀਆਂ ਹਨ ਇਹਨਾਂ ਦੇ ਮੁੱਖ ਕਾਰਨ ਹਨ ਕਿ ਜਿਵੇਂ ਕਿਸਾਨ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜੋ ਕਰਜ਼ਾ ਲੈ ਲੈਂਦਾ ਹੈ ਅਤੇ ਉਸਨੂੰ ਉਤਾਰਨ ਵਾਸਤੇ ਵਾਸਤੇ ਬਹੁਤ ਹੀ ਮੁਸ਼ਕਲ ਹੋ ਜਾਂਦਾ ਕਰਜ਼ਾ ਉਹ ਆਪਣੀਆਂ ਫਸਲਾਂ ਤੋਂ ਮੁਨਾਫਾ ਕੱਢ ਕੇ ਜੋ ਧਾਰਦਾ ਹੈ ਪਰ ਜਿੰਨਾ ਉਹ ਮੁਨਾਫਾ ਚਾਹੁੰਦਾ ਹੈ ਓਨਾ ਉਸਨੂੰ ਮਿਲਦਾ ਨਹੀਂ ਕਿਸਾਨ ਜਦੋਂ ਵੀ ਖੇਤਾਂ ਦੇ ਵਿੱਚ ਫਸਲ ਉਗਾਉਂਦਾ ਹੈ ਅਤੇ ਜਿੰਨਾ ਉਸ ਬਾਰੇ ਉਹ ਮੁਨਾਫਾ ਸੋਚਦਾ ਹੈ ਓਨਾ ਉਹ ਮੁਨਾਫਾ ਉੱਥੋਂ ਪ੍ਰਾਪ ਪ੍ਰਾਪਤ ਨਹੀਂ ਕਰ ਸਕਦਾ ਇਸਦੇ ਕਾਰਨ ਇਹ ਹਨ ਕਿ ਜਾਂ ਫਿਰ ਮੌਸਮੀ ਹਿਸਾਬ ਦੇ ਨਾਲ ਮੌਸਮ ਦੀ ਮਾਰ ਦੇ ਨਾਲ ਕਈ ਵਾਰ ਜ਼ਿਆਦਾ ਮੀਂਹ ਦੇ ਕਾਰਨ ਵੀ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਜਾਂ ਫਿਰ ਜਿੰਨਾ ਉਸਨੂੰ ਮੁਨਾਫਾ ਮਿਲਣਾ ਚਾਹੀਦਾ ਸਰਕਾਰ ਕੋਲੋਂ ਉਹ ਨਹੀਂ ਮਿਲਦਾ ਜਿੰਨਾ ਉਸਨੂੰ ਇਸ 'ਤੇ ਖਰਚਾ ਆਉਂਦਾ ਹੈ ਉਸ ਤੋਂ ਘੱਟ ਰੇ ਘੱਟ ਹੀ ਮੁਨਾਫਾ ਉਸਨੂੰ ਮਿਲਦਾ ਹੈ ਇਹ ਕੁਝ ਕਾਰਨ ਹਨ ਜਿਨ੍ਹਾਂ ਕਾਰਨ ਉਹ ਆਪਣਾ ਕਰਜ਼ਾ ਨਹੀਂ ਉਤਾਰ ਸਕਦਾ ਇਸਨੂੰ ਇਸ ਤੋਂ ਬਚਣ ਵਾਸਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੋ ਖਰਚੇ ਹਨ ਉਹਨਾਂ ਨੂੰ ਘਟਾਉਣਾ ਕਰੇ ਅਤੇ ਜਿਸਦੇ ਨਾਲ ਉਹ ਘੱਟ ਤੋਂ ਘੱਟ ਕਰਜ਼ਾ ਲੈ ਸਕੇ ਅਤੇ ਅਜਿਹਾ ਮੌਕਾ ਨਾ ਮਿਲੇ ਜਿਸ ਕਾਰਨ ਉਸ ਨੂੰ ਖੁਦਕੁਸ਼ੀ ਕਰਨੀ ਪਵੇ ਅਤੇ ਸਰਕਾਰ ਨੂੰ ਇਹ ਕਦਮ ਚੁੱਕਣੇ ਚਾਹੀਦੇ ਹਨ ਕਿ ਉਸਨੂੰ ਕਿਸਾਨਾਂ ਵਾਸਤੇ ਜੋ ਕਰਜ਼ੇ ਹਨ ਉਹਨਾਂ ਦੇ ਜੋ ਕਰਜ਼ੇ ਮੁਕਤ ਕਰਨੇ ਚਾਹੀਦੇ ਹਨ ਅਤੇ ਉਹਨਾਂ ਦੀਆਂ ਫਸਲਾਂ ਦਾ ਵਧੀਆ ਰੇਟ ਤੈਅ ਕਰਕੇ ਫਸਲਾਂ ਉਹਨਾਂ ਦੀਆਂ ਲੈਣੀਆਂ ਚਾਹੀਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਵੱਧ ਮੁਨਾਫਾ ਹੋ ਸਕੇ ਅਤੇ ਉਹ ਹੋਰ ਵੀ ਵਧੀਆ ਫਸਲਾਂ ਉਗਾਉਣ ਦੇ ਲਈ ਬਿਹਤਰ ਹੋ ਸਕੇ ਅਤੇ ਉਸਦੀਆਂ ਖੁਦਕੁਸ਼ੀਆਂ ਦੇ ਜੋ ਕਾਰਨ ਹਨ ਉਹ ਘੱਟ ਸਕਣ